ਪੰਜਾਬ ਵਿੱਚ ਮਨੋਰੰਜਨ ਦੇ ਫਿਲਮਾਂ ਤੋਂ ਇਲਾਵਾ ਜਿਹੜੇ ਹੋਰ ਸਾਧਨ ਨੇ ਉਹ ਹੈਗੇ ਨੇ ਅੱਜ ਦੇ ਜ਼ਮਾਨੇ ਦੇ ਵਿੱਚ ਮਿਸਟਰੀ ਰੂਮਸ ਮਿਸਟਰੀ ਰੂਮਸ ਜਿਹੜੇ ਨੇ ਉਹ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਪਾਪੂਲਰ ਹੋ ਰਹੇ ਨੇ ਮਿਸਟਰੀ ਰੂਮ ਦੇ ਵਿੱਚ ਹੁੰਦੇ ਨੇ ਜਿਸ ਤਰ੍ਹਾਂ ਉਹ ਡਰਾਵਣੇ ਕਮਰੇ ਔਰ ਰੂਮ ਭੂਲ ਭੁਲਈਆਂ ਵਾਲੇ ਅੱਜ ਕੱਲ੍ਹ ਕਮਰੇ ਬਣ ਰਹੇ ਨੇ ਜਿੱਥੇ ਜਿਹੜੇ ਨੇ ਨਾ ਇੱਕ ਇੱਕ ਰੋਮਾਂਚਕ ਫੀਲਿੰਗ ਆਉਂਦੀ ਹੈ ਦਰਸ਼ਕਾਂ ਨੂੰ ਉੱਥੇ ਜਾ ਕੇ ਜਦੋਂ ਜਾਂਦੇ ਨੇ ਕਿਤੇ ਸਕੈਲਟਨ ਟੰਗਿਆ ਹੋਇਆ ਕਿਤੇ ਕੋਈ ਡਰਾਵਣੀ ਚੀਜ਼ ਕਿਤੇ ਕੋਈ ਤਾਂ ਉਹ ਇੱਕ ਵਾਰੀ ਬੰਦਾ ਹਿੱਲ ਜਾਂਦਾ ਵੰਡਰਲੈਂਡ ਦੇ ਵਿੱਚ ਵੀ ਬਣਿਆ ਹੋਇਆ ਅੱਜ ਕੱਲ੍ਹ ਬਹੁਤ ਸਾਰੇ ਮੋਲਜ਼ ਦੇ ਵਿੱਚ ਅਲੱਗ ਅਲੱਗ ਰੂਮਸ ਬਣਾਏ ਨੇ ਬੱਚੇ ਉੱਥੇ ਜਾ ਕੇ ਆਮ ਫਿਲਮਾਂ ਨਾਲੋਂ ਆਮ ਮਨੋਰੰਜਨ ਕਰਨ ਨਾਲੋਂ ਇਹ ਵਾਲੇ ਕਮਰਿਆਂ ਵਿੱਚ ਜਾ ਕੇ ਜਿਹੜਾ ਮਨੋਰੰਜਨ ਕਰਨਾ ਜੈੜ ਜ਼ਿਆਦਾ ਪ੍ਰੈਫਰ ਕਰ ਰਹੇ ਨੇ ਅੱਜ ਕੱਲ੍ਹ ਇਹ ਵੇਲੇ ਮਿਸਟਰੀ ਰੂਮਸ ਦਾ ਬਹੁਤ ਜ਼ਿਆਦਾ ਰਿਵਾਜ਼ ਹੈ ਇਸ ਤੋਂ ਇਲਾਵਾ ਜਿਹੜੇ ਨੇ ਪੰਜਾਬ ਦੇ ਵਿੱਚ ਜਿਹੜੀਆਂ ਸਾਹਸੀ ਖੇਡਾਂ ਚੱਲ ਰਹੀਆਂ ਨੇ ਸਾਹਸੀ ਖੇਡਾਂ ਜਿਹੜੀਆਂ ਨੇ ਕੁਸ਼ਤੀ ਕਬੱਡੀ ਮੇਨ ਚਲਦੀਆਂ ਨੇ ਜਿਨ੍ਹਾਂ ਨੂੰ ਲੋਕ ਬਹੁਤ ਜ਼ਿਆਦਾ ਖੁਸ਼ ਹੋ ਕੇ ਦੇਖਦੇ ਨੇ ਖੇਡਣਾ ਪਸੰਦ ਕਰਦੇ ਨੇ ਇਹ ਖੇਡਾਂ ਤਾਂ ਇਹ ਵੈਸੇ ਵੀ ਬਾਹਰਲੇ ਦੇਸ਼ਾਂ 'ਚ ਵੀ ਚਲੀਆਂ ਗਈਆਂ ਨੇ ਸਾਡੀਆਂ ਕਿਉਂਕਿ ਇਹ ਉੱਥੇ ਵੀ ਲੋਕ ਜਿਹੜੇ ਉੱਥੇ ਰਹਿ ਰਹੇ ਨੇ ਉਹ ਵੀ ਸਾਹਸੀ ਖੇਡਾਂ ਨੂੰ ਬਹੁਤ ਪਸੰਦ ਕਰਦੇ ਨੇ ਅਤੇ ਇਹ ਜਿਹੜੀਆਂ ਸਾਹਸੀ ਖੇਡਾਂ ਨੇ ਇਹ ਇਹਨਾਂ ਦੇ ਅਲੱਗ ਅਲੱਗ ਪੱਧਰ ਹੁੰਦੇ ਨੇ ਪਹਿਲਾਂ ਕੁਆਟਰਫਾਈਨਲ ਸੈਮੀਫਾਈਨਲ ਫਿਰ ਫਾਈਨਲ 'ਚ ਇਹ ਕੁਸ਼ਤੀ ਕਬੱਡੀ ਜਿਹੜੀਆਂ ਨੇ ਮੇਨ ਇਸ ਦੇ ਵਿੱਚ ਇਹਦੇ ਅੰਦਰਗਤ ਆਉਂਦੀਆਂ ਨੇ